ਹਾਂ ਮੈਂ ਇਸ ਦੀ ਵਰਤੋਂ ਕੀਤੀ ਹੈ ਨੈਟਫਲਿਕਸ ਬਹੁਤ ਹੀ ਚੰਗਾ ਐਪ ਹੈ ਇਸ ਨੂੰ ਮੈਂ ਟੀ ਵੀ ਕੇਬਲ ਨਾਲੋਂ ਬਹੁਤ ਜ਼ਿਆਦੇ ਮਤਲਬ ਕਿ ਅ ਅੱਛਾ ਮੰਨਦਾ ਹਾਂ ਇਸਦੇ ਵਿੱਚ ਮਸ਼ਹੂਰੀ ਨਹੀਂ ਆਉਂਦੀ ਨਾਲੇ ਇਸਦੇ ਵਿੱਚ ਕੁਆਲਿਟੀ ਬਹੁਤ ਚੰਗੀ ਆਉਂਦੀ ਹੈ ਨਾ ਕੋਈ ਅੜਨ ਦੀ ਨਾ ਕੋਈ ਸਿਕਿਓਰ ਐਪ ਹੈ ਫੁਲ ਜੀ ਠੀਕ ਹੈ ਇਸ ਦੀ ਵਰਤੋਂ ਕਰਨ ਨਾਲ ਮੈਨੂੰ ਬਹੁਤ ਸੰਤੁਸ਼ਟੀ ਮਿਲਦੀ ਹੈ ਜੋ ਵੀ ਨਵੀਂ ਮੂਵੀ ਜਾਂ ਕੁਛ ਵੀ ਸੀਰੀਅਲ ਆਉਂਦਾ ਹੈ ਇਸਦੇ ਵਿੱਚ ਪਹਿਲਾ ਹੀ ਆ ਜਾਂਦਾ ਹੈ ਐਚ ਡੀ ਦੇ ਵਿੱਚ ਅਤੇ ਇਹ ਬਹੁਤ ਚੰਗਾ ਐਪ ਹੈ ਇਹ ਟੀ ਵੀ ਨਾਲੋਂ ਇਸ ਨੂੰ ਮੈਂ ਬਹੁਤ ਚੰਗਾ ਮੰਨਦਾ ਹਾਂ ਚ ਟੀ ਵੀ ਦੇ ਵਿੱਚ ਬਹੁਤ ਜ਼ਿਆਦੇ ਮਸ਼ਹੂਰੀਆਂ ਆਉਂਦੀਆਂ ਹਨ ਇਸ ਦੇ ਵਿੱਚ ਇੱਕ ਵੀ ਮਸ਼ਹੂਰੀ ਨਹੀਂ ਦਿੱਖਦੀ ਅਤੇ ਇਹ ਬਹੁਤ ਚੰਗਾ ਐਪ ਹੈ ਇਸਦੇ ਵਿੱਚ ਇਹਦਾ ਪ੍ਰੀਮੀਅਰ ਲੈਣਾ ਪੈਂਦਾ ਹੈ ਜੋ ਕਿ ਵਧੀਆ ਰੇਟ 'ਤੇ ਵਧੀਆ ਹੀ ਮਿਲ ਜਾਂਦਾ ਹੈ ਇਸ ਇਹ ਬਹੁਤ ਵਧੀਆ ਐਪ ਹੈ